ਸਰਕਾਰ ਕੋਲ ਅੱਜ ਕੱਲ ਬਹੁਤ ਕੰਮ ਹੈ ਸਰਕਾਰ ਲਈ ਸਾਰੇ ਵਿਭਾਗ ਦੇ ਮੁੱਦੇ ਹੁੰਦੇ ਨੇ ਅਸੀਂ ਸਾਰੇ ਵਿਭਾਗਾਂ ਦੀ ਗੱਲ ਤਾਂ ਨਹੀਂ ਕਰ ਸਕਦੇ ਪਰ ਕੁਝ ਵੀ ਬਾਗ ਜਿਵੇਂ ਕਿ ਸਿੱਖਿਆ ਸਿਹਤ ਸੰਭਾਲ ਅਤੇ ਆਰਥਕਾ ਤੇ ਆਪਾਂ ਗੱਲ ਕਰਦੇ ਹਾਂ ਕੀ ਇਸ ਉੱਤੇ ਸਰਕਾਰ ਨੇ ਕੀ ਕੀਤਾ ਹੈ ਪਹਿਲਾਂ ਆਈਏ ਸਿੱਖਿਆ ਵਿਭਾਗ ਤੇ ਇਸ ਵਿੱਚ ਸਰਕਾਰ ਸਰਕਾਰੀ ਸਕੂਲਾਂ ਨੂੰ ਕਾਫੀ ਅਪਡੇਟ ਕਰ ਰਹੀ ਹੈ ਉਸ ਵਿੱਚ ਨਵੀਂ ਨਵੀਂ ਟੈਕਨੋਲਜੀ ਲੈ ਕੇ ਆ ਰਹੀ ਹੈ ਹਰ ਸਕੂਲ ਵਿੱਚ ਕੰਪਿਊਟਰ ਲੈਬ ਬਣਾ ਰਹੀ ਹੈ ਮਿਡ ਮੀਲ ਤੇ ਵੀ ਕਾਫੀ ਧਿਆਨ ਦਿੱਤਾ ਗਿਆ ਹੈ ਜੋ ਕੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਉਸ ਦੀ ਕਾਫੀ ਸਹਾਨਤਾ ਕੀਤੀ ਜਾ ਰਹੀ ਹੈ ਇਸ ਨਾਲ ਉੱਥੇ ਪੜਨ ਤੇ ਵਾਲੇ ਕਾਫੀ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਰਿਹਾ ਹੈ ਹੁਣ ਗੱਲ ਕਰਦੇ ਹਾਂ ਸਿਹਤ ਵਿਭਾਗ ਦੀ ਸਰਕਾਰ ਨੇ ਹੁਣ ਹਰ ਮੁਹੱਲੇ ਵਿੱਚ ਮੁਹੱਲਾ ਕਲੀਨਿਕ ਬਣਾ ਦਿੱਤੀ ਹੈ ਜਿਸ ਨਾਲ ਆਮ ਜਨਤਾ ਨੂੰ ਕਾਫੀ ਫਾਇਦਾ ਹੋਇਆ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਵੀ ਕਾਫੀ ਧਿਆਨ ਦੇ ਰਹੀ ਹੈ ਉਸ ਨੂੰ ਵੀ ਕਾਫੀ ਅਪਡੇਟ ਕਰ ਰਹੀ ਹੈ ਸਰਕਾਰੀ ਹਸਪਤਾਲਾਂ ਵਿੱਚ ਵੀ ਸਾਫ ਸਫਾਈ ਦਾ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਉਥੇ ਨਵੇਂ ਨਵੀਂ ਮਸ਼ੀਨਰੀ ਵੀ ਮੰਗਵਾਈ ਜਾ ਰਹੀ ਹੈ ਜਿਸ ਨਾਲ ਉਥੋਂ ਦੀ ਆਮ ਜਨਤਾ ਨੂੰ ਕਾਫੀ ਫਾਇਦਾ ਹੋ ਰਿਹਾ ਹੈ ਅਤੇ ਉਹ ਆਪਣਾ ਇਲਾਜ ਵਧੀਆ ਤਰੀਕੇ ਨਾਲ ਕਰਵਾ ਰਹੇ ਨੇ ਉੱਥੇ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਨਵੇਂ ਨਵੇਂ ਫਰੀ ਕੈਂਪ ਵੀ ਲਗਾ ਰਹੀ ਹੈ ਅੱਖਾਂ ਦਾ ਕੈਂਪ